ਹਾਂਜੀ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਅਰਸ਼ ਦਾ ਫਾਦਰ ਬੋਲਦਾ ਪਿਆ ਹਾਂ ਉਹਨੇ ਮੈਸੇਜ ਦਿੱਤਾ ਸੀ ਮੈਮ ਦਾ ਕੋਲ ਆਉਣੀ ਹੈ ਮੈਮ ਮੈਂ ਮੈਂ ਕੱਲ੍ਹ ਚੰਡੀਗੜ੍ਹ ਗਿਆ ਸੀਗਾ ਬਿਜਨਸ ਮੀਟਿੰਗ ਲਈ ਇਸ ਕਰਕੇ ਮੈਂ ਆ ਨਹੀਂ ਪਾਇਆ ਅਤੇ ਮੇਰੀ ਵਾਈਫ ਵਰਕਿੰਗ ਆ ਹਾਂਜੀ ਮੈਮ ਇਹਦਾ ਰਿਜ਼ਲਟ ਦੇਖਿਆ ਬਹੁਤ ਘੱਟ ਮਾਰਕਸ ਆ ਇਹਦੇ ਮੈਮ ਇਹਨੂੰ ਟਿਊਸ਼ਨ ਵੀ ਪਾ ਰੱਖਿਆ ਹੈ ਉਹਦੇ ਅਤੇ ਉੱਥੇ ਪਰਫੋਰਮੈਂਸ ਇਹਦੀ ਸਹੀ ਆ ਲੇਕਿਨ ਹੁਣ ਐਕਡੈਮਿਕਸ ਦੇਖਿਆ ਜਾਵੇ ਸਕੂਲ ਦੇ ਵਿੱਚ ਇਹਦੇ ਮਾਕਸ ਬਹੁਤ ਘੱਟ ਜਾ ਰਹੇ ਇਹ ਕਿਉਂ ਟਿਊਸ਼ਨ ਦੀ ਪਰਫੋਰਮੈਂਸ ਤਾਂ ਮੈਮ ਇਹਦੀ ਟਿਊਸ਼ਨ ਟੀਚਰ ਨਾਲ ਗੱਲ ਹੁੰਦੀ ਰਹਿੰਦੀ ਮੇਰੇ ਫਰੈਂਡ ਸਰਕਲ 'ਚੋਂ ਹੀ ਹੈਗੇ ਆ ਮੇਲ ਟੀਚਰ ਹੈ ਅਤੇ ਉਹ ਤਾਂ ਕਹਿੰਦੇ ਆ ਕਿ ਠੀਕ ਹੈ ਪਰਫੋਰਮੈਂਸ ਬਾਕੀ ਉਹਦਾ ਐਵਰੇਜ ਹੈ ਮਤਲਬ ਕਿ ਪਾਸ ਵਗੈਰਾ ਹੋ ਜਾਂਦਾ ਆਰਾਮ ਨਾਲ ਟੈਸਟ 'ਚ ਹਾਂਜੀ ਹਾਂਜੀ ਹਾਂਜੀ ਮੈਮ ਇਹ ਫੋਨ ਵੀ ਬਹੁਤ ਯੂਜ ਕਰਦਾ ਮੈਂ ਇਹਦੀ ਮੈਂ ਮਦਰ ਨੂੰ ਵੀ ਕਹਿ ਕੇ ਇਹਦਾ ਫੋਨ ਵੀ ਥੋੜ੍ਹਾ ਜਿਹਾ ਰਖਵਾਇਆ ਹੈ ਅਤੇ ਹੁਣ ਮੈਂ ਕੋਈ ਨਹੀਂ ਕੋਲ ਬਹਿ ਕੇ ਨਾ ਇਹਨੂੰ ਕੋਈ ਨਹੀਂ ਮੈਂ ਇਹਦੇ ਕੋਲ ਬੈਠ ਕੇ ਫਿਰ ਸਾਰਾ ਸੋਰਟ ਕਰਵਾਉਂਦਾ ਇਹਦੇ ਤੋਂ ਮੈਨੂੰ ਤੁਹਾਡੀ ਵੀ ਹੈਲਪ ਚਾਹੀਦੀ ਇਹਦੇ ਵਿੱਚ ਥੋੜ੍ਹੀ ਸਟਿੱਕਨੈਂਸ ਮੈਂ ਕਰਦਾ ਥੋੜ੍ਹਾ ਤੁਸੀਂ ਖਿੱਚ ਕੇ ਰੱਖੋ ਇਹਨਾਂ ਦੇ ਤਾਂ ਮਾਕਸ ਥੋੜ੍ਹੀ ਇੰਪਰੂਵ ਕਰੀਏ ਹਾਂਜੀ ਚਲੋ ਠੀਕ ਹੈ ਮੈਮ ਥੈਂਕ ਯੂ ਜੀ